ਹਾਂਜੀ ਮੇਰੇ ਕੋਲ ਵੀ ਇੱਕ ਸਮਾਰਟ ਵਾਚ ਹੈ ਜੋ ਕਿ ਮੈਂ ਹਰ ਇੱਕ ਟਾਈਮ ਉਹਨੂੰ ਨਾਲ ਰੱਖਦੀ ਹਾਂ ਉਹਦਾ ਬਹੁਤ ਜ਼ਿਆਦਾ ਬੈਨੀਫਿਟ ਹੈ ਮੈਨੂੰ ਕਦੇ ਵੀ ਉਹਦੀ ਲੋੜ ਪੈਂਦੀ ਹੈ ਤਾਂ ਮੈਂ ਹਰ ਟਾਈਮ ਉਹਨੂੰ ਆਪਣੇ ਨਾਲ ਸੰਜੋਅ ਕੇ ਰੱਖਦੀ ਹਾਂ ਫਿਰ ਦੀ ਵਰਤੋਂ ਵੀ ਕੀਤੀ ਹੈ ਕਿਉਂਕਿ ਉਹਨਾਂ ਨਾਲ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਜਦੋਂ ਕਿ ਮੇਰੇ ਕੋਲ ਸਮਾਰਟ ਵਾਚ ਹੁੰਦੀ ਹੈ ਤਾਂ ਮੈਨੂੰ ਕਈ ਵਾਰ ਫੋਨ ਕਰ ਰਿਹਾ ਸਾਂ ਤਾਂ ਮੈਨੂੰ ਇੱਦਾਂ ਦਿੱਕਤ ਨਹੀਂ ਹੁੰਦੀ ਕਿ ਮੈਨੂੰ ਆਪਣਾ ਜੋ ਆਪਣੇ ਘਰਦਿਆਂ ਤੱਕ ਇਨਫੋਰਮੇਸ਼ਨ ਦੇਣੀ ਹੈ ਉਹਦੇ ਵਿੱਚ ਦਿੱਕਤ ਨਹੀਂ ਹੁੰਦੀ ਮੈਂ ਆਰਾਮ ਨਾਲ ਮੇਰੇ ਘਰਦਿਆਂ ਨੂੰ ਇਨਫੋਰਮ ਕਰ ਦਿੰਦੀ ਹਾਂ ਸੋ ਮੈਨੂੰ ਬਹੁਤ ਜ਼ਿਆਦਾ ਬੈਨੀਫਿਟ ਹੈ ਜੋ ਮੇਰੇ ਕੋਲ ਸਮਾਰਟ ਵਾਚ ਹੈਗੀ ਆ ਇਸ ਟੈਕਨੋਲਜੀ ਦਾ ਯੁੱਗ ਹੈ ਤੋ ਹਰ ਇੱਕ ਪਰਸਨ ਕੋਲ ਇੱਕ ਇੱਦਾਂ ਦਾ ਟੈਕਨੋਲਜੀ ਵਾਲਾ ਸ ਪ੍ਰੋਜੈਕਟ ਹੋਣਾ ਚਾਹੀਦਾ ਹਰ ਇੱਕ ਵਿਅਕਤੀ ਲਈ ਬਹੁਤ ਹੀ ਮਹੱਤਵਪੂਰਨ ਹੈ ਅਤੇ ਲਾਭਦਾਇਕ ਹੈ ਇਹ ਔਰ ਹਰ ਇੱਕ ਪਰਸਨ ਇਸ ਨੂੰ ਆਪਣੇ ਹੈਂਡ 'ਤੇ ਕੈਰੀ ਕਰ ਸਕਦਾ ਆਰਾਮ ਨਾਲ ਅਤੇ ਇਹਦੇ ਨਾਲ ਕੋਈ ਵੀ ਇੱਦਾਂ ਦਾ ਨਹੀਂ ਹੈਗੇ ਆਪਾਂ ਨੂੰ ਇੱਕ ਤਾਂ ਇਹਦੀ ਸਭ ਤੋਂ ਬੈਨੀਫਿਟ ਇਹ ਗੱਲ ਹੈ ਕਿ ਇਹਦੇ ਨਾਲ ਸਾਨੂੰ ਟਾਈਮ ਦਾ ਹਰ ਟਾਈਮ ਪਤਾ ਲੱਗਦਾ ਰਹਿੰਦਾ ਹੈ ਅਤੇ ਦੂਸਰਾ ਇਹ ਹੈ ਕਿ ਸਾਨੂੰ ਇਹਨੂੰ ਕੈਰੀ ਕਰਨ ਦੇ ਵਿੱਚ ਨਹੀਂ ਅੜਿੱਕ ਨਾ ਹੀ ਇਹ ਖਰਾਬ ਹੁੰਦੀ ਹੈ ਸਾਨੂੰ ਹਰ ਇੱਕ ਇਨਫੋਰਮੇਸ਼ਨ ਰਹਿੰਦੀ ਹੈ ਜਦੋਂ ਆਪਣਾ ਦਿਲ ਕਰਦਾ ਅਸੀਂ ਸੌਂਗ ਸੁਣ ਸਕਦੇ ਹੈ ਇਸ 'ਤੇ ਹਰ ਇੱਕ ਚੀਜ਼ ਦੇਖ ਸਕਦੇ ਹਾਂ ਮੈਨੂੰ ਬਹੁਤ ਪਸੰਦ ਹੈ ਜੀ